ਜੋ ਕਿ ਘੱਟ ਗਿਣਤੀ ਧਰਮ ਹੁੰਦੇ ਹਨ ਉਹਨਾਂ ਨੂੰ ਪ੍ਰਮੁੱਖ ਧਰਮ ਦੇ ਲੋਕਾਂ ਦੇ ਨਾਲ ਮਿਲਾਉਣ ਦਾ ਇੱਕ ਸਾਧਨ ਇਹ ਹੈ ਕਿ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਜੋ ਕਿ ਕਿਸੇ ਤਿਉਹਾਰ 'ਤੇ ਛੁੱਟੀ ਹੁੰਦੀ ਹੈ ਉਹ ਹਰੇਕ ਨੂੰ ਇਕੱਠੀ ਹੀ ਹੁੰਦੀ ਹੈ ਜੇਕਰ ਅਸੀਂ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਜਦੋਂ ਗੁਰਪੁਰਬ ਮਨਾਇਆ ਸੀ ਤਾਂ ਉਦੋਂ ਗੁਰਦੁਆਰੇ ਮੱਥਾ ਟੇਕਣ ਹਰ ਧਰਮ ਦੇ ਲੋਕ ਆਏ ਹੋਏ ਸਨ ਸੋ ਇਸ ਤਰ੍ਹਾਂ ਜੋ ਘੱਟ ਗਿਣਤੀ ਦੇ ਧਰਮਾਂ ਦੇ ਲੋਕ ਹਨ ਉਹ ਵੀ ਪ੍ਰਮੁੱਖ ਧਰਮ ਦੇ ਲੋਕਾਂ ਦੇ ਨਾਲ ਮਿਲ ਕੇ ਰਹਿੰਦੇ ਹਨ ਅਤੇ ਉਹਨਾਂ ਦੇ ਧਰਮ ਨੂੰ ਵੀ ਸਮਝ ਰਹੇ ਹਨ ਅੱਜ ਕੱਲ੍ਹ ਲੋਕਾਂ ਨੇ ਸਮਝ ਆਪਸੀ ਇੰਨੀ ਕਰ ਲਈ ਹੈ ਕਿ ਹੁਣ ਲੋਕ ਅੰਤਰ ਧਰਮ ਦੇ ਵਿਆਹ ਵੀ ਕਰਨ ਲੱਗ ਗਏ ਹਨ ਜਿਸ ਨਾਲ ਲੋਕਾਂ ਨੂੰ ਜੋ ਕਿ ਘੱਟ ਗਿਣਤੀ ਧਰਮਾਂ ਦੇ ਹਨ ਬ ਪ੍ਰਮੁੱਖ ਧਰਮਾਂ ਦੇ ਨਾਲ ਮਿਲ ਜੁਲ ਕੇ ਰਹਿਣਾ ਮੁਸ਼ਕਿਲ ਨਹੀਂ ਆ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਜੋ ਕਿ ਘੱਟ ਗਿਣਤੀ ਧਰਮ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਅਸੀਂ ਇੱਕ ਅਗਰ ਨੀਚਾ ਨਾ ਦਿਖਾ ਕੇ ਬਰਾਬਰੀ ਇਨਸਾਨੀਅਤ ਦਾ ਅਹੁਦਾ ਦਿਖਾ ਕੇ ਆਪਣੇ ਨਾਲ ਲੈ ਕੇ ਤੁਰਦੇ ਹਾਂ ਤਾਂ ਬਹੁਤ ਹੀ ਚੰਗਾ ਉਹਨਾਂ ਦਾ ਵੀ ਮਨ ਹੋ ਜਾਂਦਾ ਹੈ ਅਤੇ ਅਸੀਂ ਵੀ ਇੱਕ ਚੰਗੇ ਇਨਸਾਨ ਬਣ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਲੈ ਕੇ ਰੱਖ ਸਕਦੇ ਹਾਂ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਤਰੀਕਿਆਂ ਨਾਲ ਜਦੋਂ ਅਸੀਂ ਨੀਵੇਂ ਲੋਕਾਂ ਨੂੰ ਜੋ ਕਿ ਘੱਟ ਗਿਣਤੀ ਦੇ ਹਨ ਉਹਨਾਂ ਦੇ ਨਾਲ ਰਹਿੰਦੇ ਹਨ ਤਾਂ ਉਹ ਵੀ ਬਹੁਤ ਹੀ ਖੁਸ਼ ਰਹਿੰਦੇ ਹਨ